ਪੰਜਾਬੀ ਭਾਸ਼ਾ ਨੂੰ ਸੁਰੱਖਿਅਤ ਅਤੇ ਉਤਸ਼ਾਹਿਤ ਕਰਨ ਲਈ ਉੱਥੇ ਦੀ ਪੰਜਾਬ ਸਰਕਾਰ ਦੁਆਰਾ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਹਨ ਇਹਨਾਂ ਯਤਨਾਂ ਵਿੱਚ ਜਿਹੜਾ ਸਭ ਤੋਂ ਮਹੱਤਵਪੂਰਨ ਯਤਨ ਹੈਗਾ ਹੈ ਹੁਣ ਉਹ ਕੀਤਾ ਜਾ ਰਿਹਾ ਹੈਗਾ ਹੈ ਜਿੱਦਾਂ ਬਈ ਮੰਨ ਲਉ ਜਿਹੜਾ ਹੁਣ ਕੋਈ ਵੀ ਬੱਚਾ ਹੈਗਾ ਹੈ ਉਹ ਕੋਈ ਸਟੇਟ ਐਗਜ਼ਾਮ ਦੀ ਤਿਆਰੀ ਕਰਦਾ ਹੈਗਾ ਹੈ ਤਾਂ ਉਹ ਭਾਵੇਂ ਅੰ ਭਾਵੇਂ ਉਹ ਪ੍ਰਾਈਵੇਟ ਸਕੂਲ 'ਚ ਪੜ੍ਹਿਆ ਹੈ ਕੋਨਵੈਂਟ ਸਕੂਲ 'ਚ ਪੜ੍ਹਿਆ ਹੋਇਆ ਭਾਵੇਂ ਉਹ ਸਰਕਾਰੀ ਸਕੂਲ 'ਚ ਪੜ੍ਹਿਆ ਹੋਇਆ ਹੈਗਾ ਹੈ ਉਹਨੂੰ ਸ ਜਿਹਨੂੰ ਜਿਹੜਾ ਪੰਜਾਬੀ ਲਾਜ਼ਮੀ ਦਾ ਪੇਪਰ ਹੈ ਉਹਨੂੰ ਪੰਜਾਹਾਂ 'ਚੋਂ ਪੱਚੀ ਨੰਬਰ ਲੈ ਕੇ ਉਹਨੂੰ ਉਹ ਪਾਸ ਕਰਨਾ ਹੀ ਪਵੇਗਾ ਅਗਰ ਉਹ ਉਹਦੇ ਵਿੱਚੋਂ ਫੇਲ੍ਹ ਹੋ ਜਾਂਦਾ ਤਾਂ ਉਹਦੇ ਜਿਹੜੇ ਦੂਜਾ ਪੇਪਰ ਹੈ ਪੇਪਰ ਬੀ ਆ ਉਹਨੂੰ ਉਹ ਉਹਦੇ ਵਿੱਚੋਂ ਵੀ ਫੇਲ੍ਹ ਮੰਨਿਆ ਜਾਂਦਾ ਹੈਗਾ ਹੈ ਇਸ ਤਰ੍ਹਾਂ ਦੇਖਿਆ ਜਾਵੇ ਜਿਹੜਾ ਪੰਜਾਬ ਸਰਕਾਰ ਦਾ ਸਭ ਤੋਂ ਵਧੀਆ ਉਪਰਾਲਾ ਹੈਗਾ ਜਿਹੜੇ ਮੌਜੂਦਾ ਸਰਕਾਰ ਦਾ ਹੈ ਉਹ ਮੈਨੂੰ ਮੇਰੇ ਮੇਰੇ ਹਿਸਾਬ ਨਾਲ ਮੈਨੂੰ ਸਭ ਤੋਂ ਵਧੀਆ ਉਪਰਾਲਾ ਲੱਗਿਆ ਹੈ ਕਿਉਂਕਿ ਜੇ ਸਾਡੀ ਭਾਸ਼ਾ ਜੇ ਸਾਡੀ ਮਾਸ਼ ਭਾ ਮਾਤ ਭਾਸ਼ਾ ਜਿਊਂਦੀ ਰਹੇਗੀ ਇਹਦੇ ਨਾਲ਼ ਹੀ ਇਹਦਾ ਪੰਜਾਬ ਅਤੇ ਪੰਜਾਬੀਅਤ ਦਾ ਫੇਰ ਵਿਕਾਸ ਹੋ ਸਕਦਾ ਹੈਗਾ ਹੈ ਇਹਦੇ ਇਲਾਵਾ ਪੰਜਾਬ ਸਰਕਾਰ ਹੋਰ ਵੀ ਕਾਫੀ ਤਰ੍ਹਾਂ ਦੇ ਯਤਨ ਕਰ ਰਹੀ ਹੈਗੀ ਹੈ ਪੰਜਾਬੀ ਭਾਸ਼ਾ ਨੂੰ ਉੱਚਾ ਚੱਕਣ ਲਈ